ਪੰਜਾਬ ਦਾ ਸੱਭਿਆਚਾਰ ਇੱਕ ਵੱਖਰਾ ਅਤੇ ਇੱਕ ਨਿਰਾਲਾ ਸੱਭਿਆਚਾਰ ਹੈ ਜਿਸ ਵਿੱਚ ਜਿਹੜਾ ਕਿ ਭਾਰਤ ਦੀ ਮੁੱਖ ਧਾਰਾ ਸੱਭਿਆਚਾਰ ਤੋਂ ਬਿਲਕੁਲ ਵੱਖਰਾ ਹੈ ਸਭ ਤੋਂ ਵੱਧ ਇੱਥੇ ਦਸ ਗੁਰੂ ਜਿਹੜੇ ਸਿੱਖ ਸਾਹਿਬਾਨ ਦੇ ਗੁਰੂ ਹਨ ਉਹਨਾਂ ਦੀ ਜਿਹੜੇ ਸਿਖਾਏ ਹੋਏ ਸਾਨੂੰ ਕਾਇਦੇ ਹਨ ਕਾਨੂੰਨ ਹਨ ਜਿਹੜੇ ਉਹਨਾਂ ਦੇ ਸਿਖਾਏ ਹੋਏ ਜੀਵਨ ਸ਼ੈਲੀ ਹੈ ਉਹ ਇਥੋਂ ਦੇ ਲੋਕਾਂ ਦੇ ਵਿੱਚ ਰਸ ਵਸ ਗਈ ਹੈ ਅਤੇ ਉਨਾਂ ਦੇ ਖਾਣ ਪੀਣ ਤੋਂ ਲੈ ਕੇ ਉਹਨਾਂ ਦੇ ਪਹਿਰਾਵੇ ਤੋਂ ਲੈ ਕੇ ਉਹਨਾਂ ਦੇ ਜਿਹੜੇ ਉਹ ਤਿਉਹਾਰ ਮਨਾਉਂਦੇ ਹਨ ਜਿਹੜੇ ਉਹ ਆਪਣੇ ਫੰਕਸ਼ਨਸ ਕਰਦੇ ਹਨ ਜਿਹੜੀ ਉਹਨਾਂ ਦੀ ਬੋਲਬਾਣੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਹੈ ਸੋ ਹਰ ਜਿਹੜੀ ਚੀਜ਼ ਹੈ ਉਹ ਦਸਾਂ ਗੁਰੂਆਂ ਦੇ ਸਿਖਾਏ ਹੋਏ ਜਿਹੜੀ ਨਿਯਮਾਵਲੀ ਹੈ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਸ ਨੂੰ ਅਪਣਾਉਂਦੇ ਹੋਏ ਪੰਜਾਬ ਦੇ ਲੋਕ ਉਵੇਂ ਹੀ ਢਲ ਗਏ ਹਨ ਸੋ ਇੱਥੇ ਉਹਨਾਂ ਦਾ ਪਹਿਰਾਵਾ ਵੀ ਜਿਸ ਤਰਾਂ ਕਿ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਕਿ ਦਸਤਾਰ ਸਜਾਉਣ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਸਜਾਉਣ ਦਾ ਸਾਡੇ ਗੁਰੂਆਂ ਨੇ ਦੱਸਿਆ ਹੈ ਉਵੇਂ ਹੀ ਜਿਹੜੇ ਸਾਡੇ ਨੌਜਵਾਨ ਹਨ ਬਹੁਤ ਸਾਰੇ ਸਾਡੇ ਸਿੱਖ ਨੌਜਵਾਨ ਜਿਹੜੇ ਹਨ ਉਹ ਜਿਹੜੇ ਹਨ ਉਹ ਅੰਮ੍ਰਿਤ ਛਕਦੇ ਹਨ ਉਹ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਨੀਲਾ ਬਾਣਾ ਵੀ ਪਾਉਂਦੇ ਹਨ ਜਿਹੜੇ ਇਸ ਤੋਂ ਇਲਾਵਾ ਦਸਤਾਰ ਸ ਸਜਾਉਂਦੇ ਹਨ ਇਸ ਤੋਂ ਇਲਾਵਾ ਕੇਸਾਂ ਦੀ ਪਾਲਣਾ ਕਰਦੇ ਹਨ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਹਨ ਉਹ ਜਿਹੜੇ ਹਨ ਉਹ ਕੇਸਕੀ ਬੰਨਦੀਆਂ ਹਨ ਜਾਂ ਦਸਤਾਰ ਵੀ ਸਜਾਉਂਦੀਆਂ ਹਨ ਸੋ ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਹੈ ਉਹਨਾਂ ਦਾ ਖਾਣ ਪੀਣ ਵੀ ਜਿਹੜਾ ਹੈ ਉਹਨਾਂ ਦਾ ਮਿਲ ਵਰਤੋਂ ਜਿਹੜੀ ਹੈ ਉਹਨਾਂ ਦੇ ਸੁਭਾਅ ਹਨ ਉਹ ਸਭ ਜਿਹੜੇ ਹਨ ਉਹ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ 'ਤੇ ਚਲਦੇ ਹੋਏ ਉਹਨਾਂ ਨੇ ਆਪਣੇ ਜੀਵਨ ਨੂੰ ਉਵੇਂ ਦਾ ਢਾਲ ਲਿਆ ਹੈ